ਹਾਂਜੀ ਸਾਡੇ ਖੇਤਰ ਦੇ ਵਿੱਚ ਬੈਂਕ 'ਤੇ ਬੀਮਾ ਏਜੰਸੀਆਂ ਦੇ ਸੰਬੰਧ ਵਿੱਚ ਨੌਕਰੀਆਂ ਦੀ ਠੀਕ ਹੈਗੀ ਜੀ ਉਹਦੇ ਲਈ ਨਵੀਂ ਤੁਹਾਨੂੰ ਪਹਿਲਾਂ ਵੀ ਪੜ੍ਹਨਾ ਪਵੇਗਾ ਹੈ ਨਾ ਵੀ ਜੇ ਸਾਡਾ ਬੀ ਬੀਕੋਮ ਵਗੈਰਾ ਸਾਡੀ ਕੀਤੀ ਹੈਗੀ ਤਾਂ ਸਾਨੂੰ ਜਿਹੜਾ ਕਿ ਅਸੀਂ ਉਹ ਟੈਸਟ ਵਗੈਰਾ ਕਲੀਅਰ ਕਰਕੇ ਤਾਂ ਅਸੀਂ ਜਿਹੜਾ ਕੀ ਆ ਜੋਬ ਦੇ ਯੋਗ ਹੋਈ ਜਾਂਦੇ ਆਗੇ ਪਰ ਨਾਲ ਦੀ ਨਾਲ ਇਥੇ ਪ੍ਰਾਈਵੇਟ ਬੈਂਕਿੰਗ ਦੇ ਵਿੱਚ ਵੀ ਬਹੁਤ ਜਿਆਦਾ ਸਾਨੂੰ ਮੌਕੇ ਮਿਲਦੇ ਨੇ ਕਈ ਪ੍ਰਾਈਵੇਟ ਬੈਂਕਾਂ ਜਿਵੇਂ ਸਾਡੀ ਬੀਕੌਮ ਜਾ ਮੇਰੀ ਐਮਕੌਮ ਕੀਤੀ ਵੀ ਆ ਤਾਂ ਉਹ ਫਿਰ ਪ੍ਰਾਈਵੇਟ ਬੈਂਕ ਦੇ ਵਿੱਚ ਕੀ ਆ ਮੈਨੂੰ ਈਜ਼ੀਲੀ ਕੰਮ ਮਿਲ ਜਾਂਦਾ ਕਿਉਂਕਿ ਜਿਹੜਾ ਕੀ ਹੈਗਾ ਮੈਂ ਜਿਹੜਾ ਕੀ ਆ ਬੈਂਕ ਦੇ ਵਿੱਚ ਕੰਮ ਕਰ ਰਿਹਾ ਹੈਗਾ ਅਤੇ ਉਹਦੇ ਵਿੱਚ ਕੀ ਹੈਗਾ ਜਿਵੇਂ ਆਹ ਲੋਕਾਂ ਦੇ ਜਿਹੜੀਆਂ ਲਿਮਿਟਾਂ ਵਗੈਰਾ ਬਣਾਉਣ ਦਾ ਕੰਮ ਆ ਜਿਹੜਾ ਇਹ ਮੈਂ ਕਰ ਰਿਹਾ ਕਿਉਂਕਿ ਪਿੰਡ ਦੇ ਨਾਲ ਸੰਬੰਧਿਤ ਹੋਣ ਕਰਕੇ ਲੋਕ ਮੇਰੇ ਕੋਲ ਆਉਂਦੇ ਲੋਕਾਂ ਦੇ ਨਾਲ ਕਾਫੀ ਵਾਕਿਫ ਸੀ ਤਾਂ ਮੈਂ ਆਪਦੇ ਜਿਹੜੇ ਬੈਂਕ ਦੇ ਵਿੱਚੋਂ ਕੀ ਆ ਉਹਨਾਂ ਨੂੰ ਲਿਮਟਾਂ ਵਗੈਰਾ ਬਣਵਾ ਕੇ ਦੇ ਰਿਹਾ ਹੈਗਾ ਕਿਉਂਕਿ ਇਹ ਕਿਸਾਨੀ ਦੇ ਨਾਲ ਸੰਬੰਧਿਤ ਹੈਗਾ ਜਿਹੜਾ ਸਹੀ ਕਿੱਤਾ ਹੈਗਾ ਅਤੇ ਕਿਸਾਨਾਂ ਦੇ ਨਾਲ ਬਹੁਤ ਵਾਹ ਪੈਂਦਾ ਹੈਗਾ ਅਤੇ ਸਿੱਧਾ ਉਹ ਬੈਂਕ 'ਚੋਂ ਆਉਂਦੇ ਮੇਰੇ ਕੋਲੇ ਤੇ ਮੈਂ ਉਹਨਾਂ ਨੂੰ ਕੰਮ ਜਿਹੜਾ ਕੀ ਆ ਕਰਵਾ ਕੇ ਦਿੰਦਾ ਉਹਨਾਂ ਦਾ ਕੰਮ